ਦੌੜ ਦੌੜਨਾ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ ਅਤੇ ਲਾਈ ਲਾਭਦਾਇਕ ਹੈ ਪਰ ਮੇਰੀ ਮਨਪਸੰਦ ਦੌੜ ਜਿਹੜੀ ਹੈ ਉਹ ਹੈ ਕਿ ਅਸੀਂ ਸੌ ਮੀਟਰ ਦੌੜ ਦੌੜਦੇ ਹੁੰਦੇ ਸੀ ਆਪਣੇ ਸਕੂਲ ਦੇ ਟਾਈਮ ਦੇ ਦੌਰਾਨ ਅਤੇ ਉਸੇ ਦੌਰਾਨ ਅਸੀਂ ਹੋਰ ਵੀ ਹਰਡਲ ਚੇਂਨਜ ਅਤੇ ਰੋਕ ਦੌੜ ਵੀ ਦੌੜਦੇ ਹੁੰਦੇ ਸੀ ਤਿੰਨ ਸੌ ਮੀਟਰ ਦੀਆਂ ਦੌੜਾਂ ਵੀ ਲਗਾਉਂਦੇ ਹੁੰਦੇ ਸੀ ਚਾਰ ਸੌ ਮੀਟਰ ਸੋਲ੍ਹਾਂ ਸੌ ਮੀਟਰ ਇਹ ਮੇਰੀਆਂ ਪਸੰਦੀਦਾ ਦੌੜਾਂ ਰਹੀਆਂ ਹਨ ਇਹਦੇ ਨਾਲ ਨਾਲ ਇੱਕ ਮੇਰੀ ਬਹੁਤ ਹੀ ਮਨਪਸੰਦ ਯਾਦਗਾਰ ਹੈ ਦੌੜ ਦੇ ਦੌਰਾਨ ਹੀ ਅਸੀਂ ਦੋ ਦੋਸਤ ਆਪਸ ਦੇ ਵਿੱਚ ਇਕ ਲੱਤ ਨੂੰ ਬੰਨ੍ਹ ਕੇ ਅਤੇ ਫੇਰ ਇੱਕ ਦੌੜ ਦੌੜਨ ਵਾਸਤੇ ਗਏ ਸਨ ਇੱਕ ਕੋਂਪੀਟੀਸ਼ਨ ਦੇ ਵਿੱਚ ਪਰ ਉਸ ਮੁਕਾਬਲੇ ਦੇ ਦੌਰਾਨ ਜਦੋਂ ਅਸੀਂ ਆਪਣੀ ਇੱਕ ਇੱਕ ਲੱਤ ਆਪਸ ਵਿੱਚ ਬੰਨ੍ਹ ਕੇ ਅਤੇ ਫੇਰ ਦੌੜ ਰਹੇ ਸਨ ਤਾਂ ਉਸੇ ਦੌਰਾਨ ਅਸੀਂ ਬੜੀ ਬੁਰੀ ਤਰ੍ਹਾਂ ਗਿਰੇ ਉਸ ਦੌਰਾਨ ਸਾਨੂੰ ਹਾਸਾ ਵੀ ਆ ਰਿਹਾ ਸੀ ਪਰ ਸਾਡੇ ਸੱਟਾਂ ਵੀ ਲੱਗ ਗਈਆਂ ਚੋ ਚੋਟਾਂ ਲੱਗਣ ਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਦੌੜ ਦੇ ਵਿੱਚ ਹਾਰਨ ਦਾ ਸਾਹਮਣਾ ਵੀ ਕਰਨਾ ਪਿਆ ਪਰ ਸਾਨੂੰ ਹਾਸਾ ਇਸ ਗੱਲ ਦਾ ਅਤੇ ਉਹ ਯਾਦਗਾਰ ਪਲ ਸਾਡੇ ਲਈ ਅੱਜ ਵੀ ਸਾਡੀ ਜ਼ਿੰਦਗੀ 'ਚ ਸਾਨੂੰ ਯਾਦ ਹੈ ਕਿ ਉਹ ਦੌੜਨ ਦੇ ਦੌਰਾਨ ਸਾਡੇ ਸੱਟਾਂ ਵੀ ਲੱਗੀਆਂ ਅਤੇ ਛੋਟੇ ਛੋਟੇ ਬੱਚੇ ਸਾਡੇ ਤੋਂ ਉਸ ਦੌੜ ਦੇ ਵਿੱਚੋਂ ਬਹੁਤ ਅੱਗੇ ਨਿਕਲ ਗਏ ਅਤੇ ਉਹ ਉਸ ਦੌੜ ਨੂੰ ਜਿੱਤ ਗਏ ਪਰ ਅਸੀਂ ਉਹ ਦੌੜ ਹਾਰ ਗਏ